ਮੈਂ ਆਪਣੇ ਇਲਾਕੇ ਵਿੱਚ ਪ੍ਰੀਤ ਟਰੈਵਲ ਨੂੰ ਜਾਣਦਾ ਮੈਂ ਉਹਨੂੰ ਪਰਸਨਲੀ ਜਾਣਦਾ ਉਹ ਮੇਰੇ ਬੜੇ ਖਾਸ ਬੰਦਿਆਂ ਵਿੱਚੋਂ ਹੋਏ ਹੈ ਮੇਰਾ ਦੋਸਤ ਹੀ ਹੈ ਉਹ ਟਿਕਟਾਂ ਦਾ ਕੰਮ ਕਰਦੇ ਹਨ ਅਤੇ ਬਹੁਤ ਹੀ ਅੱਛੇ ਉਹਨਾਂ ਦੀ ਡੀਲਿੰਗ ਬੜੀ ਅੱਛੀ ਆ ਉਹ ਉਹਨਾਂ ਕੋਲ ਕਈ ਵਾਰ ਅਸੀਂ ਟਿਕਟਾਂ ਕਰਵਾਈਆਂ ਉਹ ਕਾਫੀ ਘੱਟ ਰੇਟ 'ਤੇ ਟਿਕਟਾਂ ਦਿੰਦੇ ਨੇ ਅਤੇ ਉਨ੍ਹਾਂ ਨੇ ਕਈ ਵਾਰ ਮਾਰਕੀਟ ਰੇਟ ਤੋਂ ਵੀ ਥੱਲੇ ਕਰਕੇ ਸਾਨੂੰ ਟਿਕਟਾਂ ਦਿੱਤੀਆਂ ਨੇ ਅਤੇ ਅਸੀਂ ਅ ਅਗਲੀ ਵਾਰ ਜਿੰਨੀ ਵਾਰੀ ਵੀ ਕਿਸੇ ਨੇ ਸਾਨੂੰ ਟਿਕਟਾਂ ਕਰਵਾਉਣ ਨੂੰ ਕਿਹਾ ਅਸੀਂ ਉਹਨਾਂ ਨੂੰ ਹੀ ਕਹਿੰਦੇ ਹਾਂ ਹੁਣ ਥੋੜ੍ਹੇ ਦਿਨ ਪਹਿਲੇ ਅਸੀਂ ਕਨੇਡਾ ਦੀਆਂ ਚਾਰ ਟਿਕਟਾਂ ਕਰਵਾਈਆਂ ਉਸ ਅਸੀਂ ਉਹਨਾਂ ਕੋਲੋਂ ਕਰਵਾਈਆਂ ਅਸੀਂ ਸਾਰੇ ਪੂਰੇ ਪੰਜਾਬ 'ਚ ਕ ਸਰਵੇ ਕੀਤਾ ਸੀਗਾ ਇੰਨੀ ਸਸਤੀ ਟਿਕਟ ਸਾਨੂੰ ਕਿਤੋਂ ਨਹੀਂ ਮਿਲੀ ਜਿੰਨੀ ਟਿਕਟ ਸਸਤੀ ਉਹਨੇ ਦੇ ਦਿੱਤੀ ਹੈ ਉਹ ਐਕਚੁਲੀ ਕੀ ਆ ਉਹ ਇਕੱਠੀਆਂ ਟਿਕਟਾਂ ਕੰਪਨੀਆਂ ਕੋਲੋਂ ਏਅ ਏਅਰਲਾਈਨਸ ਵਾਲਿਆਂ ਕੋੋਲੋਂ ਚੁੱਕ ਲੈਂਦੇ ਨੇ ਉਹ ਵੀ ਓਫ ਸੀਜਨ ਵਿੱਚ ਅਤੇ ਇਸ ਕਰਕੇ ਉਹਨਾਂ ਤੋਂ ਸਸਤੀ ਟਿਕਟ ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਕੋਈ ਦੇ ਸਕਦਾ ਹੈ